ਇਹ ਪ੍ਰਥਾਵਾਂ ਸ਼ੁਰੂ ਤੋਂ ਚੱਲੀਆਂ ਆ ਰਹੀਆਂ ਹਨ ਪੁਰਾਤਨ ਸਮੇਂ ਤੋਂ ਇਸਦਾ ਆਸਥਾ ਦੇ ਨਾਲ਼ ਲੋਕ ਜੁੜੇ ਹੋਏ ਹਨ ਇਸ ਦੇ ਨਾਲ਼ ਲੋਕ ਆਪਣੇ ਆਪ ਨੂੰ ਧਰਮ ਨਾਲ਼ ਜੁੜਿਆ ਹੋਇਆ ਮਹਿਸੂਸ ਕਰਦੇ ਹਨ ਅਤੇ ਇਹ ਚੀਜ਼ਾਂ ਨੂੰ ਰੱਖ ਕੇ ਉਹ ਮੰਨਦੇ ਹਨ ਕਿ ਉਹਨਾਂ ਦੇ ਉਹ ਆਪਣੇ ਰੱਬ ਦੀ ਪੂਜਾ ਕਰ ਰਹੇ ਹਨ ਅਤੇ ਇਹ ਉਹਨਾਂ ਦੀ ਪੂਜਾ ਕਰਨ ਦਾ ਇੱਕ ਤਰੀਕੇ ਹਨ